ਮੇਰੇ ਘਰ ਦੀ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਉਂਦਾ ਸੀਗਾ ਇਸ ਕਰਕੇ ਮੈਂ ਬਿਜਲੀ ਦਫਤਰ ਫੋਨ ਕੀਤਾ ਬਿਜਲੀ ਵਾਲੇ ਨੂੰ ਪੁੱਛਿਆ ਯੂਨਿਟ ਮਹਿੰਗੀ ਬਹੁਤ ਜ਼ਿਆਦਾ ਹੋ ਗਈ ਸੀਗੀ ਇਸ ਕਰਕੇ ਉਨ ਉਹਨਾਂ ਨੂੰ ਪੁੱਛਿਆ ਉਹ ਕਹਿੰਦਾ ਕਹਿੰਦੇ ਵੀ ਦਿਓ ਦੋ ਤਰੀਕੇ ਨਾਲ ਬਿਜਲੀ ਆ ਸਕਦੀ ਆ ਮੈਨੂੰ ਤਾਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਉਹ ਕਹਿੰਦਾ ਕਹਿੰਦੇ ਕੀ ਇੱਕ ਪਾਣੀ ਅਤੇ ਬਿਜਲੀ ਬਣ ਸਕਦੀ ਆ ਇੱਕ ਸੂਰਜ ਦੇ ਰਾਹੀਂ ਬਿਜਲੀ ਆ ਸਕਦੀ ਹੈ ਸੋ ਸੋਲਰ ਸਿਸਟਮ ਨਾਲ ਅਤੇ ਤਾਂ ਕਰਕੇ ਫਿਰ ਮੈਂ ਇਕ ਪਾਣੀ ਦਾ ਤਾਂ ਕੋਈ ਇੰਤਜ਼ਾਮ ਹੈ ਨਹੀਂ ਸੀ ਸੋਲਰ ਸਿਸਟਮ ਨਾਲ ਹੀ ਇੱਕ ਬਿਜਲੀ ਦਾ ਕਰਵਾਇਆ ਆ ਤਾਂ ਕਰਕੇ ਮੇਰੇ ਆਪਣੇ ਘਰ ਬਿਜਲੀ ਆਉਣ ਲੱਗੀ ਹੈ ਸੂਰਜ ਦੇ ਰਾਹੀਂ ਛੱਤ ਛੱਤ ਤਾਂ ਕਰਵਾਇਆ ਸਾਰਾ ਕੰਮ ਤਾਂ ਕਰਕੇ ਮੇਰੇ ਬਿਜਲੀ ਆਉਣ ਲੱਗੀ ਹੈ